ਦੋ ਫਰਵਰੀ ਉੱਨੀ ਸੌ ਸਤਾਨਵੇਂ ਪੰਜ ਮਾਰਚ ਦੋ ਹਜ਼ਾਰ ਦੋ ਨੌ ਅਪ੍ਰੈਲ ਉੱਨੀ ਸੌ ਨੱਬੇ ਪੰਦਰਾਂ ਜੂਨ ਉੱਨੀ ਸੌ ਚੁਰਾਨਵੇਂ ਛੇ ਅਗਸਤ ਦੋ ਹਜ਼ਾਰ ਉੱਨੀ